ਵੈਸੇ ਤਾਂ ਮੇਰੇ ਇਲਾਕੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਪਾਣੀ ਦੀ ਕਮੀ ਹੋਣ ਦੀ ਕੋਈ ਉਮੀਦ ਹੈ ਪਰ ਜੇ ਕਿਤੇ ਇਹ ਜਿਹੜਾ ਪਾਣੀ ਹੈ ਨਗਰ ਪਾਲਿਕਾ ਵੱਲੋਂ ਆਉਂਦਾ ਹੈ ਵਾਟਰ ਵਾਕਸ ਦਾ ਅਤੇ ਜੇ ਕਿਤੇ ਇਹ ਨਾ ਵੀ ਆਵੇ ਤਾਂ ਲੋਕਾਂ ਨੇ ਆਪਣੇ ਘਰ ਸਮਰਸੀਬਲ ਪੰਪ ਲਾਏ ਹੋਏ ਹਨ ਅਤੇ ਮੇਰੇ ਖਿਆਲ 'ਚ ਤਾਂ ਪਾਣੀ ਦੀ ਕਮੀ ਨਹੀਂ ਹੈ ਬਾਕੀ ਜੇ ਕਮੀ ਹੋਈ ਵੀ ਤਾਂ ਉਹਦੇ ਲਈ ਨਗਰ ਪਾਲਿਕਾ ਨੇ ਉਪਾਅ ਕੀਤੇ ਹੋਏ ਹਨ